ਮੋੋਹਾਲੀ ਜ਼ਿਲ੍ਹੇ ਵਿੱਚ ਸਥਾਨਕ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਇਸ ਦੀ ਵਿਧਾਇਕ ਅਨਮੋਲ ਗਗਨ ਮਾਨ ਹੈ ਇਸ ਦੇ ਨਾਲ਼ ਨਾਲ਼ ਇੱਕ ਚੰਗੀ ਗਾਇਕਾ ਅਤੇ ਇੱਕ ਚੰਗੀ ਇਨਸਾਨ ਵੀ ਹੈ ਇਸਨੇ ਆਪਣੇ ਜ਼ਿਲ੍ਹੇ ਵਿੱਚ ਕਾਨੂੰਨ ਵਿਵਸਥਾ ਦੇ ਸੁਧਾਰ ਲਈ ਬਹੁਤ ਸਖ਼ਤ ਕਦਮ ਚੁੱਕੇ ਹਨ ਅਤੇ ਬੱਚਿਆਂ ਦੀ ਪੜ੍ਹਾਈ ਦੇ ਲਈ ਸਕੂਲਾਂ ਕਾਲਜਾਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਹਨ ਅਤੇ ਹਰ ਚੀਜ਼ ਮੁਹਿੰਮ ਕਰਵਾਈ ਹੋਈ ਹੈ ਤਾਂ ਜੋ ਸਿੱਖਿਆ ਪੱਧਰ ਨੂੰ ਉੱਚਾ ਚੁੱਕਿਆ ਜਾ ਜਾ ਸਕੇ ਅਤੇ ਖੇਡ ਪੱਧਰ ਨੂੰ ਉੱਚਾ ਚੁੱਕਣ ਲਈ ਗਰਾਊਡਾਂ ਦੀ ਵਿਵਸਥਾ ਸਮਾਨ ਦੀ ਵਿਵਸਥਾ ਅਤੇ ਖਿਡਾਰੀਆਂ ਨੂੰ ਕੌਚਾਂ ਦੀ ਵਿਵਸਥਾ ਦਿੱਤੀ ਹੋਈ ਹੈ ਤਾਂ ਜੋ ਖੇਡ ਪੱਧਰ ਵਿੱਚ ਪੰਜਾਬ ਦਾ ਨਾਮ ਉੱਚਾ ਚੁੱਕਿਆ ਜਾ ਸਕੇ ਕੁਲਵੰਤ ਰੰਧਾਵਾ ਅਤੇ ਇੱਕ ਕੁਲਜੀਤ ਰੰਧਾਵਾ ਇਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਹਨਾਂ ਦਾ ਸਾਥ ਦਿੱਤਾ ਤਾਂ ਜੋ ਖੇਡ ਪੱਧਰ ਕਾਨੂੰਨ ਵਿਵਸਥਾ ਅਤੇ ਹਰ ਪਾਸੇ ਜੋ ਪੰਜਾਬ ਵਿੱਚ ਮੋਹਾਲੀ ਜ਼ਿਲ੍ਹੇ ਨੂੰ ਉੱਚਾ ਚੁੱਕਿਆ ਜਾ ਸਕੇ